ਮੈਨੂੰ ਬਾਗਬਾਨੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਨੂੰ ਨਵੇਂ ਨਵੇਂ ਪੌਦੇ ਫ ਫੁੱਲਾਂ ਦੇ ਪੌਦੇ ਜਾਂ ਫਲਾਂ ਦੇ ਪੌਦੇ ਲਗਾਉਣਾ ਬਹੁਤ ਹੀ ਜ਼ਿਆਦਾ ਸ਼ੌ ਸ਼ੌਂਕ ਹੈ ਮੈਂ ਆਪਣੇ ਘਰ ਵਿੱਚ ਗੁਲਾਬ ਦੇ ਪੌਦੇ ਸੂਰਜਮੁਖੀ ਦੇ ਅਤੇ ਗੇਂਦੇ ਦੇ ਇਹ ਸਭ ਪੌਦੇ ਲਗਾ ਰੱਖੇ ਆ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਸ਼ੌਕੀਨ ਹਾਂ ਮੈਂ ਇਹਨਾਂ ਦੇ ਮੈਨੂੰ ਫੁ ਫੁੱਲ ਬਹੁਤ ਜਿਆਦਾ ਸੋਹਣੇ ਲੱਗਦੇ ਆ ਦੇਖਣ ਵਿੱਚ ਹੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਅਤੇ ਫਲਾਂ ਦੀ ਵੀ ਮੈਂ ਬਹੁਤ ਵਧੀਆ ਸ਼ੌਕੀਨ ਹਾਂ ਕਿਉਂਕਿ ਫਲ ਖਾਣਾ ਆਪਣੀ ਸਿਹਤ ਲਈ ਵੀ ਚੰਗਾ ਹੁੰਦਾ ਅਤੇ ਮੈਂ ਫਲ ਵੀ ਉਗਾਉਂਦੀ ਹਾਂ ਮੈਂ ਅਤੇ ਮੇਰੇ ਪਿਤਾ ਜੀ ਬਹੁਤ ਚੰਗੀ ਚੰਗੀ ਤਰੀਕੇ ਇਹਨਾਂ ਦੀ ਦੇਖਭਾਲ ਕਰਦੇ ਹਾਂ ਜਿਵੇਂ ਕਿ ਹੁਣ ਫਲਾਂ ਦੇ ਫਲਾਂ ਦਾ ਅਸੀਂ ਖਾ ਆਪ ਸ ਗ ਲੈਂਦੇ ਹਾਂ ਆਪ ਖਾਂਦੇ ਹਾਂ ਅਤੇ ਇਹਨਾਂ ਹੋਰ ਉਗਾਉਂਦੇ ਵੀ ਹਾਂ ਤਾਂ ਕਿ ਅਸੀਂ ਅੱਗੇ ਵੀ ਫਲ ਫੁੱਲ ਫਲ ਖਾ ਸਕੀਏ ਫਲ ਅਤੇ ਫੁੱਲ ਸਾਨੂੰ ਦੇਖਣ 'ਚ ਵੀ ਬਹੁਤ ਸੋਹਣੇ ਲੱਗਦੇ ਇਸ ਨਾਲ ਸਾਡਾ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਅਤੇ ਜਿਵੇਂ ਕਿ ਸਾਡਾ ਪੂਰਾ ਦਾ ਪੂਰਾ ਘਰ ਵੀ ਵਧੀਆ ਠੰਡੀ ਛਾਵਾਂ ਨਾਲ ਰਹਿੰਦਾ ਹੈ ਸਾਨੂੰ ਫਲ ਅਤੇ ਫੁੱਲ ਵਾਲੇ ਪੌਦੇ ਬਹੁਤ ਜ਼ਿਆਦਾ ਚੰਗੇ ਲੱਗਦੇ ਆ ਇਕੱਲੇ ਫਲ ਅਤੇ ਫੁੱਲ ਵਾਲੇ ਨਹੀਂ ਵੈਸੇ ਸਾਰੇ ਪੌਦੇ ਚੰਗੇ ਲੱਗਦੇ ਆ ਕਿਉਂਕਿ ਸਾਰੇ ਪੌਦਿਆਂ ਨਾਲ ਸਾਡੇ ਆਕਸੀਜਨ ਲੈਵਲ ਵਧੀਆ ਰਹਿੰਦਾ ਹੈ ਅਤੇ ਪ ਪੇੜ ਪੌਦੇ ਸਾਨੂੰ ਬਹੁਤ ਜ਼ਿਆਦਾ ਚੀਜ਼ਾਂ ਦਿੰਦੇ ਹਨ ਮ ਦਵਾਈ ਹੋ ਗਈ ਲੱਕੜ ਹੋ ਗਈ ਇਹ ਸਭ ਚੀਜ਼ਾਂ ਬਹੁਤ ਸਾਨੂੰ ਮਿਲਦੀਆਂ ਹਨ ਅਤੇ ਪੇੜ ਪੌਦਿਆਂ ਨਾਲ ਇਹ ਇੱਕ ਤਾਂ ਹੜ੍ਹ ਨਹੀਂ ਆਉਂਦੇ ਅਤੇ ਇੱਕ ਦੂਜਾ ਇੱਕ ਤਾਂ ਹੜ੍ਹ ਨਹੀਂ ਆਉਂਦੇ ਅਤੇ ਦੂਜਾ ਕੋਈ ਸਾਨੂੰ ਨੁਕਸਾਨ ਵੀ ਨਹੀਂ ਹੁੰਦਾ ਅਤੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਪੇੜ ਪੌਦੇ ਲਗਾਉਣੇ ਚਾਹੀਦੇ ਹੈ ਤਾਂ ਕਿ ਸਾਡਾ ਵਾਤਾਵਰਨ ਵੀ ਖੁਸ਼ਨੁਮਾ ਰਵੇ ਵਾਤਾਵਰਨ ਵੀ ਚੰਗਾ ਰਹੇ ਅਤੇ ਸਾਨੂੰ ਬਹੁਤ ਜ਼ਿਆਦਾ ਵਧੀਆ ਹਵਾ ਅਤੇ ਸਾਨੂੰ ਪੇੜ ਪੌਦਿਆਂ ਦੇਖਭਾਲ ਵੀ ਕਰਨੀ ਚਾਹੀਦੀ ਹੈ ਪਾਣੀ ਪਾਉਣਾ ਚਾਹੀਦਾ ਹੈ ਉਹਨਾਂ ਨੂੰ ਪ੍ਰੋਪਰ ਸਾਰਾ ਕੁਛ ਦੇਣਾ ਚਾਹੀਦਾ ਹੈ ਇਸ ਕਰਕੇ ਪੇੜ ਪੌਦੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹੈ ਫਲਾਂ ਦਾ ਅਸੀਂ ਇਹੀ ਕਰਦੇ ਹਾਂ ਵੀ ਅਸੀਂ ਖੁਦ ਖਾਂਦੇ ਹਾਂ ਅਤੇ ਫਲ ਫੁਲ ਬਹੁਤ ਜ਼ਿਆਦਾ ਉਗਾਉਂਦੇ ਵੀ ਹਾਂ ਤਾਂ ਕਿ ਲੋਕਾਂ ਨੂੰ ਵੀ ਇਹਦੀ ਮਦਦ ਮਿਲੇ ਅਤੇ ਅਸੀਂ ਆਪਦੇ ਗੁਆਂਢੀਆਂ ਨੂੰ ਵੀ ਫ ਫਲ ਖਵਾਉਂਦੇ ਹਾਂ ਧੰਨਵਾਦ